ਸਤਿ ਸ਼੍ਰੀ ਅਕਾਲ ਅਸੀਂ ਆਪਣੇ ਘਰ ਵਿੱਚ ਦੋ ਪਸ਼ੂ ਰੱਖੇ ਹੋਏ ਨੇ ਇੱਕ ਗਾਂ ਅਤੇ ਇੱਕ ਕੁੱਤਾ ਪਹਿਲੇ ਕਿ ਮੈਂ ਗਾਂ ਦੇ ਬਾਰੇ ਦੱਸਣਾ ਚਾਹੁੰਦਾ ਹੈ ਗਾਂ ਨੂੰ ਸਾਡੇ ਹਿੰਦੂ ਧਰਮ ਵਿੱਚ ਮਾਤਾ ਸਮਾਨ ਮੰਨਿਆ ਜਾਂਦਾ ਅਤੇ ਅਸੀਂ ਗਾਂ ਦੀ ਬਹੁਤ ਹੀ ਦੇਖਭਾਲ ਕਰਦੇ ਹਾਂ ਅਤੇ ਅਸੀਂ ਗਾਂ ਨੂੰ ਟਾਈਮ ਟੂ ਟਾਈਮ ਪੱਠੇ ਪਾਉਂਦੇ ਹਾਂ ਟਾਈਮ ਟੂ ਟਾਈਮ ਪਾਣੀ ਦਿੰਦੇ ਹਾਂ ਟਾਇਮ ਟੂ ਟਾਈਮ ਉਹਦੀ ਸਾਫ਼ ਸਫਾਈ ਕਰਦੇ ਹਾਂ ਜਿੱਥੇ ਆਪਾਂ ਗਾਂ ਰੱਖੀ ਹੁੰਦੀ ਆ ਉਸ ਜਗ੍ਹਾ ਦੀ ਸਾਫ਼ ਸਫਾਈ ਕਰਦੇ ਹਾਂ ਸਾਨੂੰ ਗਾਂ ਦੇ ਨਾਲ ਨਾਲ ਗਾਂ ਦੇ ਬਹੁਤ ਫ਼ਾਇਦੇ ਹੈ ਸਾਨੂੰ ਗਾਂ ਦੁੱਧ ਦਿੰਦੀ ਹੈ ਫਿਰ ਅਸੀਂ ਦੁੱਧ ਨੂੰ ਪੀਂਦੇ ਹਾਂ ਪੀ ਕੇ ਸਾਡੇ ਸਰੀਰ ਵਿੱਚ ਕਈ ਸਾਰੀ ਬਿਮਾਰੀਆਂ ਨੂੰ ਦੂਰ ਕਰਦਾ ਹੈ ਅਤੇ ਅਸੀਂ ਜਿਹੜਾ ਬਚੇ ਦਾ ਦੁੱਧ ਹੁੰਦਾ ਉਹਦਾ ਆਪਾਂ ਦਹੀਂ ਬਣਾ ਲੈਂਦੇ ਹਾਂ ਦਹੀਂ ਦਹੀਂ ਤੋਂ ਬਾਅਦ ਦਹੀਂ ਨੂੰ ਖਾ ਲੈਂਦੇ ਹਾਂ ਰੋਟੀ ਨਾਲ ਫਿਰ ਬਚੇ ਹੋਏ ਦੁੱਧ ਨਾਲ ਆਪਾਂ ਘਿਓ ਕੱਢ ਲੈਂਦੇ ਹਾਂ ਅਤੇ ਬਹੁਤ ਹੀ ਫ਼ਾਇਦੇ ਸਨ ਗਾਂ ਦੇ ਨਾਲ ਅਤੇ ਅਸੀਂ ਗਾਂ ਬਹੁਤ ਹੀ ਦੇਖ ਭਾਲ ਕਰਦੇ ਹਾਂ ਅਤੇ ਦੂਸਰਾ ਸਾਡਾ ਪਸ਼ੂ ਆ ਕੁੱਤਾ ਆ ਸਾਡਾ ਇਕ ਕੁੱਤਾ ਹੈ ਛੋਟਾ ਜਿਹਾ ਉਹਦਾ ਨਾਮ ਹੈ ਟਫੀ ਆ ਹੀ ਉਹਨੂੰ ਆਪਣੇ ਨਾਲ ਹੀ ਘਰ ਦੇ ਅੰਦਰ ਰੱਖੇਦਾ ਹੁੰਦਾ ਹੈ ਅਤੇ ਉਹਨੂੰ ਆਪਾਂ ਰੋਟੀ ਰਾਟੀ ਖਵਾਉਂਦੇ ਆਹਾਂ ਟਾਈਮ ਟੂ ਟਾਈਮ ਖਵਾਉਂਦੇ ਆ ਟਾਈਮ ਟੂ ਟਾਈਮ ਨਵਾਉਂਨੇ ਆਂ ਟਾਈਮ ਟੂ ਟਾਈਮ ਉਹਨੂੰ ਬਾਹਰ ਲੈ ਕੇ ਜਾਂਦੇ ਟਾਈਮ ਟੂ ਟਾਈਮ ਉਹਨੂੰ ਅੰਦਰ ਸਵਾ ਦਿੰਦੇ ਉਹਦੇ ਟਾਈਮ 'ਤੇ ਧੰਨਵਾਦ